ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਜਤ ਜਤਿੰਦਰ ਸਿੰਘ ਗੱਲ ਕਰ ਰਿਹਾਂ ਸਰ ਮੈਂ ਨਾ ਬਰਗਰ ਦਾ ਆਰਡਰ ਕੀਤਾ ਸੀਗਾ ਜੀ ਓਹ ਐਕਚੂਲੀ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੁਹਾਡੇ ਆਰਡਰ ਕਨਫ਼ਰਮ ਕਨਫਰਮੇਸ਼ਨ ਦਾ ਮੈਨੂੰ ਮੈਸੇਜ ਆ ਗਿਆ ਸੀਗਾ ਜੀ ਲੇਕਿਨ ਅਜੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਨੂੰ ਥੋੜ੍ਹਾ ਅਰਜੈਂਨਟ ਕੰਮ ਪੈ ਗਿਆ ਇਸ ਕਰਕੇ ਮੈਂ ਤੁਹਾਡਾ ਆਰਡਰ ਕੈ ਰੱਦ ਕਰਨਾ ਚਾਹੁੰਦਾ ਸਰ ਅਗਰ ਤੁਸੀਂ ਕਰ ਸਕਦੇ ਰੱਦ ਤਾਂ ਮੈਨੂੰ ਕਨਫਰਮੇਸ਼ਨ ਕਰ ਦਿਓ ਸਰ ਮੈਨੂੰ ਮੈਸੀਜ ਦੇ ਦਿਓ ਲੇਕਿਨ ਮੈਨੂੰ ਤੁਹਾਡੀ ਸਰਵਿਸ ਚੰਗੀ ਲੱਗੀ ਤੁਹਾਡਾ ਕੌਲ ਵੀ ਟੈਮ 'ਤੇ ਆਇਆ ਸੀਗਾ ਪ੍ਰੋਬਲਮ ਆ ਗਈ ਸੀਗੀ ਥੋੜ੍ਹਾ ਅਰਜਨਟ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ ਸਰ ਇਸ ਕਰਕੇ ਮੈਂ ਤੁਹਾਡਾ ਆਰਡਰ ਕੈਂਸਲ ਕਰਨਾ ਚਾਹੁੰਦਾ ਸਰ ਅਗਰ ਤੁਸੀਂ ਤੇ ਕਰ ਸਕਦੇ ਆਰਡਰ ਤਾਂ ਕੈਂਸਲ ਕਰ ਦਿਓ ਸਰ ਮੈਨੂੰ ਮੈਸਜ ਵਗੈਰਾ ਦੇ ਕੇ ਦੱਸ ਦਿਓ ਅਗਰ ਮੇਰੇ ਕੋਲ ਟਾਈਮ ਹਜੇ ਹੈ ਨਹੀਂ ਸਰ ਤ ਅਗਰ ਦੁਬਾਰਾ ਮੈਂ ਤੁਹਾਨੂੰ ਆਰਡਰ ਕਰਨਾ ਹੋਏਗਾ ਤੁਹਾਨੂੰ ਮੈਂ ਕੌਲ ਕਰ ਦਾਗਾਂ ਉਸ ਹਿਸਾਬ ਨਾਲ ਹਾਂਜੀ ਹੈਲੋ ਠੀਕ ਏ ਸਰ ਇਸ ਕਰਕੇ ਮੈਨੂੰ ਆਰਡਰ ਪਲੀਜ਼ ਮੇਰਾ ਕੈਂਸਲ ਕਰ ਦਿਓ ਮੇਰੀ ਇਹੀ ਬੇਨਤੀ ਆ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਜੀ ਆਪਾਂ ਚਲੋ ਠੀਕ ਆ ਸਰ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ